ਹੈਲੋ ਸਤਿ ਸ਼੍ਰੀ ਅਕਾਲ ਕੌਣ ਬੋਲ ਰਿਹਾ ਜੀ ਅੱਛਾ ਅੱਛਾ ਹਾਂਜੀ ਹਾਂਜੀ ਹਾਂਜੀ ਬਿਲ ਹਾਂਜੀ ਮੈਡਮ ਹਾਂਜੀ ਹਾਂਜੀ ਆਇਆ ਸੀਗਾ ਨੀਕੁੰਜ ਬਾਈ ਹੋਨਾ ਦਾ ਫੋਨ ਆਇਆ ਸੀਗਾ ਠੀਕ ਹੈ ਜੀ ਜੰਮੂ ਤੋਂ ਵੈਸੇ ਤਾਂ ਸਾਰੇ ਹੀ ਸਹੀ ਹੈ ਚਾਹੇ ਤੁਸੀਂ ਟਰੇਨ 'ਚ ਆ ਜਾਓ ਚਾਹੇ ਤੁਸੀਂ ਬੱਸ ਆ ਜਾਓ ਜੇ ਮੰਨ ਲਓ ਤੁਸੀਂ ਟਰੇਨ 'ਚ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਥੋਂ ਟ੍ਰੇਨ ਪਕੜ ਕੇ ਪਹਿਲਾਂ ਜਲੰਧਰ ਕੈਂਟ ਆਉਣਾ ਪਊਗਾ ਕਿਉਂਕਿ ਜ਼ਿਆਦਾਤਰ ਟਰੇਨਸ ਉੱਥੋਂ ਹੀ ਮਿਲਦੀਆਂ ਸਿਟੀ ਦੀ ਇੱਕ ਅੱਧੀ ਹੁੰਦੀ ਤਾਂ ਪ੍ਰੈਫਰ ਮੈਂ ਇਹ ਹੀ ਕਰਾਂਗਾ ਕਿ ਤੁਸੀਂ ਕੈਂਟ ਉੱਤਰ ਕੇ ਉੱਥੋਂ ਜਲੰਧਰ ਬੱਸ ਸਟੈਂਡ ਚਲੇ ਜਾਓ ਨਾਲ ਹੀ ਹੈ ਉੱਥੋਂ ਥੋੜ੍ਹੀ ਦੂਰੀ 'ਤੇ ਅਤੇ ਉੱਥੋਂ ਤੁਹਾਨੂੰ ਬੱਸ ਮਿਲ ਜਾਵੇਗੀ ਕਪੂਰਥਲਾ ਵਾਸਤੇ ਅਤੇ ਜੇ ਜੇ ਤੁਸੀਂ ਬੱਸ 'ਚ ਆਉਣਾ ਚਾਹੁੰਦੇ ਹੋ ਬੱਸ ਵੀ ਆ ਸਕਦੇ ਹੋ ਜੰਮੂ ਤੋਂ ਸਿੱਧੀ ਜਲੰਧਰ ਦੀ ਬੱਸ ਮਿਲ ਜਾਣੀ ਤੁਹਾਨੂੰ ਜਲੰਧਰ ਬੱਸ ਸਟੈਂਡ ਉੱਤਰ ਕੇ ਅਤੇ ਉੱਥੋਂ ਤੁਸੀਂ ਆਪਣਾ ਕਪੂਰਥਲਾ ਦੀ ਬਸ ਸਾਰੇ ਪੰਦਰ੍ਹਾਂ ਮਿੰਟ ਹੀ ਹੈਗੀ ਹੈ ਜ਼ਿਆਦਾ ਦੂਰ ਨਹੀਂ ਹੈਗਾ ਉੱਥੋਂ ਕੋਈ ਹਾ ਹਾਰਡਲੀ ਪੱਚੀ ਤੀਹ ਕਿਲੋਮੀਟਰ ਹੀ ਹੈ ਦੇਖੋ ਤੁਸੀਂ ਇਕੱਲੇ ਆਉਣਾ ਹੈ ਕਿ ਨਾਲ ਹੋਰ ਵੀ ਇੱਕ ਹੈਗੇ ਆ ਕੇ ਮੈਂਬਰਸ ਦੇਖੋ ਫਿਰ ਦੇਖ ਜਿੱਦਾਂ ਹੁਣ ਨਿਕੁੰਜ ਹੋਰਾਂ ਦਾ ਰੈਫਰੈਂਸ ਹੈਗਾ ਅਤੇ ਮੈਂ ਤਾਂ ਇਹ ਹੀ ਸਜੈਸਟ ਕਰਾਂਗਾ ਜੇ ਇਕੱਲੇ ਆਉਣਾ ਫਿਰ ਗੱਡੀ 'ਚ ਆਉਣ ਦੀ ਲੋੜ ਨਹੀਂ ਕਿਉਂਕਿ ਇੱਕ ਤਾਂ ਰਸਤਾ ਲੰਬਾ ਹੈਗਾ ਅਤੇ ਪਲਸ ਖਰਚਾ ਵੀ ਜ਼ਿਆਦਾ ਪੈਂਦਾ ਟ੍ਰੇਨ ਨੇ ਨਾਲ ਛੇਤੀ ਪਹੁੰਚਾ ਦੇਣਾ ਪ ਖਰਚਾ ਵੀ ਘੱਟ ਲੱਗਣਾ ਹੈ ਹਾ ਬ ਆਂ ਗੁਰੂ ਨਾਨਕ ਦੇਵ ਜੀ ਦੇ ਜਨਮਸਲੀ ਕਿਹਾ ਜਾਂਦਾ ਜੀ ਸੁਲਤਾਨਪੁਰ ਉਹ ਕਪੂਰਥਲੇ ਤੋਂ ਲਗਭਗ ਕੋਈ ਪੱਚੀ ਛੱਬੀ ਕਿਲੋਮੀਟਰ ਹੀ ਹੈ ਅੱਗੇ ਅਤੇ ਉੱਥੇ ਹੈਗਾ ਗੁਰਦੁਆਰਾ ਬੇਰ ਸਾਹਿਬ ਹੈ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਮਤਲਬ ਸ ਆਪਣੇ ਪਾਣੀ ਦੇ ਸਮਾਧੀ ਲੈ ਕੇ ਅਤੇ ਆਪਣਾ ਜਦੋਂ ਵਾਪਸ ਆਏ ਸੀ ਤਿੰਨ ਦਿਨਾਂ ਬਾਅਦ ਤਾਂ ਉਹਨਾਂ ਨੇ ਆਪਣਾ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ ਬਿਲਕੁਲ ਹੈਗੇ ਆ ਜਲੰਧਰ ਵੱਲ ਨੂੰ ਹੈਗੀ ਆ ਥੋੜ੍ਹੀ ਦੂਰ ਹੀ ਆ ਕੋਈ ਪੰਜ ਕੁ ਕਿਲੋਮੀਟਰ ਦੂਰ ਹੈ ਬੱਸ ਸਟੈਂਡ ਤੋਂ ਕਪੂਰਥਲੇ ਅਤੇ ਹਾਂਜੀ ਇਹ ਡੇਲੀ ਖੁੱਲ੍ਹਦੀ ਹੈ ਸੱਤੋ ਦਿਨ ਚੱਲਦੀ ਹੈਗੀ ਹੈ ਟਾਈਮਿੰਗ ਸਵੇਰੇ ਕੋਈ ਨੌਂ ਕੁ ਵਜੇ ਸ਼ੁਰੂ ਹੋ ਜਾਂਦਾ ਹੈਗਾ ਅਤੇ ਸ਼ਾਮ ਸੱਤ ਵਜੇ ਤੱਕ ਓਪਨ ਰਹਿੰਦਾ ਹੈ ਜੀ ਸਾਇੰਸ ਸਿਟੀ ਹਾਂ ਡੇਲੀ ਸੈਵਨ ਡੇਜ ਵੀਕ ਹੈ ਜੀ ਠੀਕ ਹੈ ਜੀ ਕੋਈ ਗੱਲ ਨਹੀਂ ਜੇ ਕੋਈ ਹੋਰ ਵੀ ਇੱਦਾਂ ਇਨਫੋਰਮੇਸ਼ਨ ਚਾਹੀਦੀ ਹੋਊਗੀ ਕਰ ਲੈਣਾ ਫੋਨ ਬੇਝਿੱਜਕ ਕੋਈ ਦਿੱਕਤ ਨਹੀਂ ਓਕੇ ਜੀ